ਮੇਰੀ ਖੁਦ ਦੀ ਇੱਛਾ ਸਭ ਤੋਂ ਜ਼ਿਆਦਾ ਮੇਰੀ ਫੌਜ ਵਿੱਚ ਜਾਣ ਦੀ ਇੰਡੀਅਨ ਆਰਮੀ ਜੋਆਇਨ ਕਰਨ ਦੀ ਇੱਛਾ ਹੈ ਮੇਰੇ ਪਿੰਡ ਦਾ ਮੇਰਾ ਯਾਰ ਦੋਸਤ ਹੀ ਮੇਰਾ ਪਰਵਿੰਦਰ ਸਿੰਘ ਫੌਜੀ ਹੈ ਉਹਦੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਖੁਦ ਨੂੰ ਉਤਸ਼ਾਹ ਹੁੰਦਾ ਹੈ ਅਤੇ ਉਸਦਾ ਜੋਸ਼ ਦੇਖ ਕੇ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਫੌਜ ਵਿੱਚ ਜਾਵਾਂ ਮੈਂ ਹਰ ਰੋਜ਼ ਸ਼ਾਮ ਨੂੰ ਗਰਾਊਂਡ ਸਾਢੇ ਪੰਜ ਵਜੇ ਜਾਂਦਾ ਹਾਂ ਅਤੇ ਆਪਣੀ ਰਨਿੰਗ ਦੀ ਪ੍ਰੈਕਟਿਸ ਕਰਦਾ ਹਾਂ ਜਿਸ ਲਈ ਮੈਂ ਆਪਣੀ ਫੌਜ ਦੀ ਸਿਲੈਕਸ਼ਨ ਕਰ ਸਕਾਂ ਫੌਜ 'ਚ ਸਿਲੈਕਟ ਹੋ ਸਕਾਂ ਅਤੇ ਫੌਜ ਦੀ ਵਰਦੀ ਪਾਉਣ ਦਾ ਮੈਂ ਬਹੁਤ ਹੀ ਚਾਹਵਾਨ ਹਾਂ